ਜਿੱਦਾ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਰਤ ਲਈ ਬਹੁਤ ਹੀ ਨਵੇਂ ਉਪਚਾਰ ਕੀਤੇ ਹਨ ਅਤੇ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਾਇਆ ਹੈ ਅਤੇ ਸਾਡੇ ਭਾਰਤ ਵਾਸੀਆਂ ਨੂੰ ਵਾਲੇ ਦੇਸ਼ਾਂ ਨਾਲ ਸਾਡੇ ਮੇਲ ਜੋੜ ਨੂੰ ਬਹੁਤ ਵਧਾਇਆ ਹੈ ਅਤੇ ਭਾਰਤੀ ਅਤੇ ਬਾਹਰਲੇ ਦੇਸ਼ਾਂ ਦੇ ਸੰਬੰਧਾਂ ਨੂੰ ਬਹੁਤ ਈ ਵਧੀਆ ਵਧੀਆ ਤਰੀਕੇ ਨਾਲ ਚਲਾਇਆ ਹੈ ਅਤੇ ਜਿਵੇਂ ਕੀ ਪੰਜਾਬ ਸਾਡੇ ਭਾਰਤ ਦਾ ਇੱਕ ਮੁੱਖ ਹਿੱਸਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨਾਂ ਨੇ ਪੰਜਾਬ ਵਿੱਚ ਬਹੁਤ ਹੀ ਨਵੀਆਂ ਸੁਵਿਧਾਵਾਂ ਚਲਾਈਆਂ ਹਨ ਵੱਡੇ ਤੋਂ ਛੋਟੇ ਦੀ ਲੈ ਕੇ ਹਰ ਸਕੀਮ ਨੂੰ ਇੱਕ ਵਧੀਆ ਤਰੀਕੇ ਨਾਲ ਚਲਾਇਆ ਹੈ ਅਤੇ ਉਹ ਉਨਾਂ ਨੇ ਪੰਜਾਬ ਵਿੱਚ ਬੁੱਢਿਆਂ ਦੀ ਪੈਨਸ਼ਨ ਲਗਵਾਈ ਹੈ ਅਤੇ ਉਹਨਾਂ ਨੂੰ ਹਰ ਇੱਕ ਜੋ ਵੀ ਉਹਨਾਂ ਦੀ ਲੋੜ ਸਬੰਧੀ ਚੀਜਾਂ ਹਨ ਉਹਨਾਂ ਦੀ ਹਰ ਇੱਕ ਚੀਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਅਤੇ ਉਹਨਾਂ ਨੂੰ ਉਹਨਾਂ ਲਈ ਬਹੁਤ ਹੀ ਨਵੇਂ ਨਵੇਂ ਜਿਵੇਂ ਕੀ ਜਿਵੇਂ ਕੀ ਸੱਥ ਅਤੇ ਬੁੱਢਿਆਂ ਲਈ ਬੈਠਣ ਲਈ ਵੱਡੇ ਵੱਡੇ ਧਰਮਸ਼ਾਲਾ ਖੋਲੀਆਂ ਹਨ ਅਤੇ ਬੱਚਿਆਂ ਲਈ ਸਕੂਲ ਅਤੇ ਉਨ੍ਹਾਂ ਦੀ ਫੀਸਾਂ ਮਾਫ ਕੀਤੀਆਂ ਹਨ ਅਤੇ ਜਿਹੜੇ ਅੰਗਹੀਣ ਬੱਚੇ ਹਨ ਉਨ੍ਹਾਂ ਲਈ ਹਰ ਸੁਵਿਧਾ ਦਾ ਪ੍ਰਬੰਧ ਕੀਤਾ ਹੈ ਅਤੇ ਉਹਨਾਂ ਨੂੰ ਹਰ ਇੱਕ ਸੁਵਿਧਾ ਦਵਾਈ ਹੈ ਭਾਰਤ ਅਤੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਸਾਡੇ ਭਾਰਤ ਨੂੰ ਇੱਕ ਵਧੀਆ ਅਤੇ ਸਵੱਛ ਦੇਸ਼ ਬਣਾਇਆ ਹੈ